ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਬਣਾਈਆਂ ਹਨ ਪੇਂਟਿੰਗ ਅਤੇ ਡਰਾਇੰਗ ਦੇ ਨਾਲ ਜਿਹਨਾਂ 'ਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਪਰ ਮੈਨੂੰ ਯਾਦ ਹੈ ਕਿ ਮੈਂ ਇੱਕ ਚੀਜ਼ ਬਣਾਈ ਸੀ ਜਿਹਦੀ ਜਿਹਦਾ ਅਰਥ ਬਹੁਤ ਹੀ ਡੁੰਘਾਈ ਦੇ ਵਿੱਚ ਸੀਗਾ ਅਤੇ ਮੈਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਉਹ ਮੇਰੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਹੈ ਮੈਂ ਇੱਕ ਵਾਰੀ ਬੇਟੀ ਪੜਾਓ ਬੇਟੀ ਬਚਾਓ 'ਤੇ ਇੱਕ ਡਰਾਇੰਗ ਬਣਾਈ ਸੀ ਜਿਹੜੀ ਮੈਂ ਇੱਕ ਐਗਜੀਬਿਸ਼ਨ ਦੇ ਵਿੱਚ ਵੀ ਲਗਾਈ ਸੀ ਜਿਹੜੀ ਲੋਕਾਂ ਨੇ ਬਹੁਤ ਪਸੰਦ ਕੀਤੀ ਅਤੇ ਮੈਂ ਉਹਦੀਆਂ ਕਾਪੀਆਂ ਵੀ ਉੱਥੇ ਰੱਖੀਆਂ ਸਨ ਜੋ ਲੋਕਾਂ ਨੇ ਬਹੁਤ ਚਾਹ ਕੇ ਖਰੀਦੀਆਂ ਸਨ ਮੈਨੂੰ ਉਹਦਾ ਮਹੱਤਵ ਬਾਚੋਂ ਪਤਾ ਚੱਲਿਆ ਕਿ ਉਹ ਇੰਨੀ ਮਹੱਤਵਪੂਰਨ ਸੀ ਕਿ ਲੋਕਾਂ ਨੇ ਉਸਨੂੰ ਇੰਨਾਂ ਹੀ ਪਸੰਦ ਕੀਤਾ ਅਤੇ ਇੰਨਾਂ ਜ਼ਿਆਦਾ ਖਰੀਦਿਆ ਬਾਅਦ ਵਿੱਚ ਵੀ ਮੈਂ ਉਹਨੂੰ ਹੋਰ ਵਧੀਆ ਤਰੀਕੇ ਨਾਲ ਬਣਾ ਕੇ ਐਗਜ਼ੀਬੀਸ਼ਨ ਦੇ ਵਿੱਚ ਲਗਾਇਆ ਜਿਹਨਾਂ ਨੂੰ ਲੋਕਾਂ ਨੇ ਹੋਰ ਵੀ ਜ਼ਿਆਦਾ ਪਸੰਦ ਕੀਤਾ ਮੈਨੂੰ ਯਾਦ ਹੈ ਮੈਂ ਬਹੁਤ ਸਾਰੀਆਂ ਡਰਾਇੰਗਾਂ ਬਣਾਈਆਂ ਹਨ ਪਰ ਇਹ ਉਹਨਾਂ ਦੇ ਵਿੱਚੋਂ ਇੱਕ ਬਹੁਤ ਚੰਗੀ ਡਰਾਇੰਗ ਅਤੇ ਡੁੰਘਾਈ ਅਰਥ ਦੇ ਨਾਲ ਬਣੀ ਸੀ